ਸਾਡੇ ਖੇਤਰ ਪਟਿਆਲੇ ਦੇ ਵਿੱਚ ਹੀ ਇੱਕ ਬਾਰਾਂਦਰੀ ਨਾਮ ਦਾ ਪਾਰਕ ਹੈ ਇਸ ਪਾਰਕ ਦੇ ਵਿੱਚ ਅਕਸਰ ਅਸੀਂ ਛੁੱਟੀ ਦੇ ਵੇਲੇ ਹੀ ਜਾਂਦੇ ਹਾਂ ਜਦੋਂ ਅਸੀਂ ਵਿਹਲੇ ਹੋਈਏ ਸ਼ਾਮ ਨੂੰ ਜਾਂ ਫਿਰ ਜਦੋਂ ਸਾਡੀ ਛੁੱਟੀ ਹੋਵੇ ਐਤਵਾਰ ਦੀ ਜਾਂ ਸ਼ਨੀਵਾਰ ਦੀ ਅਸੀਂ ਉੱਥੇ ਜ਼ਰੂਰ ਜਾਂਦੇ ਹਾਂ ਪੂਰੇ ਪਰਿਵਾਰ ਸਮੇਤ ਇੱਕ ਤਰ੍ਹਾਂ ਦੀ ਸਾਡੀ ਪਿਕਨਿਕ ਹੀ ਮਨਾਈ ਜਾਂਦੀ ਆ ਉੱਥੇ ਜਾ ਕੇ ਬਾਰਾਂਦਰੀ ਪਾਰਕ ਦੇ ਵਿੱਚ ਬਾਰਾਂ ਦਰਵਾਜ਼ੇ ਨੇ ਤਾਂ ਕਰਕੇ ਉਹਨੂੰ ਬਾਰਾਂਦਰੀ ਕਿਹਾ ਗਿਆ ਇਹ ਬਹੁਤ ਹੀ ਜ਼ਿਆਦਾ ਵੱਡਾ ਇੱਕ ਪਾਰਕ ਹੈ ਜਿਹਦੇ ਵਿੱਚ ਕਿ ਲੱਖਾਂ ਹੀ ਤਰੀਕੇ ਦੀਆਂ ਰੁੱਖ ਨੇ ਬੂਟੇ ਨੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਵਾਲੇ ਬੂਟੇ ਫਲਾਂ ਵਾਲੇ ਬੂਟੇ ਕਹਿ ਸਕਦੇ ਹੋ ਤੁਸੀਂ ਅਤੇ ਦਵਾਈਆਂ ਵਾਲੇ ਬੂਟੇ ਵੀ ਕਹਿ ਸਕਦੇ ਹੋ ਹਮੇਸ਼ਾ ਅਸੀਂ ਜਦੋਂ ਵੀ ਜਾਈਦਾ ਆ ਅਤੇ ਜਾ ਕੇ ਤਰ੍ਹਾਂ ਤਰ੍ਹਾਂ ਦੇ ਬੂਟਿਆਂ ਦੇ ਅਸੀਂ ਦੇਖਦੇ ਹਾਂ ਨਾਮ ਦੇਖਦੇ ਹਾਂ ਉਹਨਾਂ ਦੇ ਉਹਨਾਂ ਦੀ ਛਾਵੇਂ ਬੈਠਦੇ ਹਾਂ ਬਹੁਤ ਹੀ ਜ਼ਿਆਦਾ ਸੰਤੁਸ਼ਟ ਭਰੀ ਜਗ੍ਹਾ ਆ ਇਹ ਇੰਨੀ ਜ਼ਿਆਦਾ ਪੀਸਫੁਲ ਕਿ ਤੁਸੀਂ ਇੱਕ ਵਾਰੀ ਉੱਥੇ ਜਾ ਕੇ ਆਪਣਾ ਘਰ ਭੁੱਲ ਜਾਂਦੇ ਹੋ ਅਤੇ ਉੱਥੇ ਬੈਠ ਕੇ ਸਾਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ ਨੇ ਅਸੀਂ ਆਨੰਦ ਮਾਣਦੇ ਹਾਂ ਪੰਛੀਆਂ ਦੀਆਂ ਆਵਾਜ਼ਾਂ ਦਾ ਅਤੇ ਬੱਚਿਆਂ ਦੇ ਲਈ ਉੱਥੇ ਝੂਲੇ ਵੀ ਲੱਗੇ ਹੋਏ ਹਨ ਜਦੋਂ ਸਾਡੇ ਨਾਲ ਬੱਚੇ ਹੁੰਦੇ ਨੇ ਤਾਂ ਬੱਚੇ ਉੱਥੇ ਜਾ ਕੇ ਆਪਣਾ ਖੇਲਦੇ ਕੁੱਦਦੇ ਨੇ ਅਲੱਗ ਤੋਂ ਹੀ ਇੱਕ ਯੋਗਾ ਵਾਸਤੇ ਵੀ ਜਗ੍ਹਾ ਬਣਾਈ ਹੋਈ ਆ ਉੱਥੇ ਸਾਡੇ ਬਜ਼ੁਰਗ ਜਦੋਂ ਜਾਂਦੇ ਨੇ ਤਾਂ ਉੱਥੇ ਯੋਗਾ ਕਰਦੇ ਨੇ ਅਸੀਂ ਵੀ ਉੱਥੇ ਜਾ ਕੇ ਕੁਝ ਨਾ ਕੁਝ ਜ਼ਰੂਰ ਸਿੱਖਦੇ ਹਾਂ ਕਿਉਂਕਿ ਵੱਡੇ ਵਡੇਰੇ ਉੱਥੇ ਆਏ ਹੁੰਦੇ ਨੇ ਉਹਨਾਂ ਦੀ ਸੰਗਤ ਦੇ ਵਿੱਚ ਬਹਿ ਕੇ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿ ਇੰਨੇ ਜ਼ਿਆਦਾ ਗਿਆਨ ਵਾਲੇ ਵੱਡੇ ਵਡੇਰੇ ਸਾਡੇ ਨਾਲ ਜੁੜਦੇ ਨੇ ਅਤੇ ਸਾਡੀ ਸੰਗਤ ਦੇ ਵਿੱਚ ਅਸੀਂ ਉਹਨਾਂ ਨਾਲ ਰਹਿੰਦੇ ਹਾਂ